ਹੈਲੋ ਹੈਲੋ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਅਸੀਂ ਨਾ ਹੰਡਾਇਆ ਪਿੰਡ ਤੋਂ ਬੋਲਦੇ ਸੀ ਹਾਂਜੀ ਤੁਸੀਂ ਆਪਣੇ ਸ਼ਰਮਾ ਫੋਟੋਗ੍ਰਾਫ਼ਰਸ ਬੋਲਦੇ ਹੋ ਹਾਂਜੀ ਵੀਰ ਜੀ ਨਾ ਆਪਾਂ ਨੂੰ ਨਾ ਪ੍ਰੋਗਰਾਮ ਸੀ ਦੋ ਤਿੰਨ ਪ੍ਰੋਗਰਾਮ ਸੀਗੇ ਆਪਾਂ ਨੂੰ ਕੈਮਰਾਮੈਨ ਚਾਹੀਦੇ ਜੀ ਫੋ ਫੋਟੋਵਾਂ ਖਿੱਚਣ ਵਾਸਤੇ ਮੂਵੀ ਵਗੈਰਾ ਬਣਾਉਣ ਵਾਸਤੇ ਹਾਂਜੀ ਮਿਲ ਜਾਂਦੀ ਆ ਜੀ ਆਪਣੇ ਕੋਲ ਡੇਟ ਸਾਡੀ ਹੈਗੀ ਆ ਤ ਤਿੰਨ ਨਵੰਬਰ ਅਤੇ ਜਾਗੋ ਹੈਗੀ ਅਤੇ ਚਾਰ ਨਵੰਬਰ ਨੂੰ ਆਪਣੇ ਬਰਾਤ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਕੈਮਰਾਮੈਨ ਵੀ ਚਾਹੀਦਾ ਹਾਂਜੀ ਹਾਂਜੀ ਮੂਵੀ ਵਗੈਰਾ ਵੀ ਹੈਗਾ ਹਾਂਜੀ ਹਾਂ

ਹਾਂਜੀ ਹਾਂਜੀ ਅਲੱਗ ਅਲੱਗ ਡੇਟ ਦੇ ਨੇ ਬਲਕਿ ਤਿੰਨ ਤਰੀਕ ਦਾ ਆਪਣੀ ਜਾਗੋ ਹੋਜੂਗੀ ਹਾਂਜੀ ਹਾਂ ਅਤੇ ਉਸ ਤੋਂ ਬਾਅਦ ਚਾਰ ਨੂੰ ਆਪਣੇ ਮੈਰਿਜ ਹੈ ਜੀ ਅਤੇ ਪੰਜ ਨੂੰ ਪੰਜ ਨੂੰ ਵੀ ਜਿਵੇਂ ਮਾੜਾ ਮੋਟਾ ਸ਼ਗਨ ਹੁੰਦਾ ਹੁੰਦਾ ਹੋਜੂਗਾ ਹਾਂਜੀ ਹਾਂ ਹਾਂਜੀ

ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਅਤੇ ਚਾਰਜ ਵਗੈਰਾ ਕੀ ਲੈਂਦੇ ਆ ਸਰ ਤੁਸੀਂ ਹਾਂਜੀ ਅੱਛਾ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਹਾਂ

ਹਾਂਜੀ ਹਾਂਜੀ ਹਾਂਜੀ ਜਾ ਸਾਡੇ ਨਾ ਆਪਣੇ ਗੁਆਂਢ ਦੇ ਵਿੱਚ ਮੈਰਿਜ ਸੀਗੀ ਆਪਣੇ ਪਿਛਲੇ ਮਹੀਨੇ ਅਤੇ ਉੱਥੇ ਤੁਹਾਡੇ ਕੈਮਰਾਮੈਨ ਵਗੈਰਾ ਆਏ ਸੀਗੇ ਅਸੀਂ ਉਹਨਾਂ ਤੋਂ ਤੁਹਾਡਾ ਨੰਬਰ ਲੈ ਲਿਆ ਸੀਗਾ ਅਤੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਸੀਗਾ ਵੀ ਉਹਨਾਂ ਨੂੰ ਹੀ ਭੇਜਿਓ ਹਾਂਜੀ ਹਾਂਜੀ ਹਾਂਜੀ ਹਾਂ ਨਹੀਂ ਉਹਨਾਂ ਨੇ ਬਹੁਤ ਵਧੀਆ ਸ਼ੂਟਿੰਗ ਵਗੈਰਾ ਵਧੀਆ ਕੀਤੀ ਸੀਗੀ ਪੋਜ਼ ਵਗੈਰਾ ਵਧੀਆ ਬਣਵਾਏ ਸੀਗੇ ਬਹੁਤ ਵਧੀਆ ਲੱਗਿਆ ਉਹਨਾਂ ਦਾ ਸਾਰਾ ਸਿਸਟਮ ਅਤੇ ਤਾਂ ਹੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਅਤੇ ਸ਼ੌਪ ਕਿੱਥੇ ਕੁ ਆ ਵੀਰ ਜੀ ਆਪਣੀ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਜੀ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਸਰ ਟਾਈਮ ਕੱਢ ਕੇ ਕੱਲ੍ਹ ਜਾਂ ਪਰਸੋਂ ਨੂੰ ਅਸੀਂ ਆਉਂਦੇ ਹਾਂ ਅਤੇ ਨਾਲੇ ਡੇਟ ਫਾਈਨਲ ਕਰ ਲਾਂਗੇ ਨਾਲੇ ਆਪਾਂ ਫਿਰ ਕੀ ਆ ਪੈਸੇ ਵਗੈਰਾ ਦੀ ਗੱਲ ਕਰ ਲਾਂਗੇ ਹਾਂਜੀ ਹਾਂ ਬਸ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਚਲੋ ਜੀ ਕੱਲ੍ਹ ਨੂੰ ਫਿਰ ਆਵਾਂਗੇ ਵੀ ਤੁਹਾਡੇ ਕੋਲ ਹੈਂ ਠੀਕ ਹੈ ਵੀਰ ਜੀ ਸ ਸਤਿ ਸ਼੍ਰੀ ਅਕਾਲ ਜੀ ਓ